ਮੈਂ ਪਹਿਲੀਆਂ ਦਸ ਜਮਾਤਾਂ ਮਾਡਲ ਸਟੱਡੀ ਸਕੂਲ ਤੁੰਗਾ ਮਜੀਠਾ ਰੋਡ ਵਿਖੇ ਕੀਤੀਆਂ ਉਸ ਤੋਂ ਬਾਅਦ ਮੈਂ ਗਿਆਰਵੀਂ ਦੇ ਵਿੱਚ ਦਾਖਲਾ ਲਿਆ ਕਾਲਜ ਦੇ ਵਿੱਚ ਜਿਸ ਦਾ ਨਾਂ ਫਾਰਸ ਕਾਲਜ ਔਫ ਕਮਰਸ ਹੈ ਫਿਰ ਮੈਂ ਉੱਥੇ ਗ੍ਰੈਜੂਏਸ਼ਨ ਕਰਨ ਦਾ ਵੀ ਸੋਚਿਆ ਅਤੇ ਪੂਰੇ ਗਿਆਰਵੀਂ ਬਾਰਵੀਂ ਅਤੇ ਬੀਕੌਮ ਦੇ ਤਿੰਨ ਸਾਲ ਉੱਥੇ ਲਗਾਏ ਟੋਟਲ ਪੂਰੇ ਪੰਜ ਸਾਲਾਂ ਬਾਅਦ ਮੈਂ ਫਿਰ ਬੀਐਡ ਕਾਲਜ ਕੋਲਜ ਅੰਮ੍ਰਿਤਸਰ ਵਿਖੇ ਉੱਥੇ ਕੀਤ ਕੀਤੀ ਬੀਐਡ ਵਧੀਆ ਨੰਬਰਾਂ ਨਾਲ ਪਾਸ ਕਰਕੇ ਫਿਰ ਮੈਂ ਉੱਚੀ ਸਿੱਖਿਆ ਲੈਣ ਦਾ ਸੋਚਿਆ ਜੋ ਕਿ ਫਿਰ ਮੈਂ ਯੂਨੀਵਰਸਿਟੀ ਜੀ ਐੱਨ ਡੀ ਯੂ ਅੰਮ੍ਰਿਤਸਰ ਵਿਖੇ ਐੱਮਕੌਮ ਦੀ ਡਿਗਰੀ ਕਰਨਾ ਸ਼ੁਰੂ ਕੀਤਾ ਫਿਰ ਮੈਂ ਉਹ ਪਾਸ ਕਰਕੇ ਫਿਰ ਮੈਨੂੰ ਵ ਵਧੀਆ ਟੀਚਰ ਦੀ ਨੌਕਰੀ ਮਿਲ ਗਈ ਅਤੇ ਮੈਂ ਫਿਰ ਪੜ੍ਹਾ ਪੜ੍ਹਾਈ ਤੋਂ ਬਾਅਦ ਇੱਕ ਟੀਚਰ ਲਾਈਨ ਦੀ ਨੌਕਰੀ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਅਤੇ ਉਹਨਾਂ ਦਾ ਭਵਿੱਖ ਸੁਧਾਰਨ ਦੇ ਵਿੱਚ ਲਗਾਉਣੀ ਸ਼ੁਰੂ ਕਰ ਦਿੱਤੀ